ਸਰੋਤਾਂ ਦੀ ਘਾਟ ਕਰਕੇ ਸਾਡੇ ਖੇਤਰ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਹਰ ਪਿੰਡ ਦੇ ਵਿੱਚ ਜਿਹੜੀ ਹੈਲਥ ਡਿਸਪੈਂਸਰੀ ਹੈ ਉਹ ਨਹੀਂ ਹੁੰਦੀ ਕਈ ਕਈ ਪਿੰਡਾਂ ਨੂੰ ਇੱਕੋ ਡਿਸਪੈਂਸਰੀ ਲੱਗਦੀ ਹੈ ਅਤੇ ਉਹਦੇ ਵਿੱਚ ਇੱਕੋ ਹੀ ਸਰਕਾਰੀ ਡੋਕਟਰ ਹੁੰਦਾ ਹੈ ਅਤੇ ਉਹ ਵੀ ਕਈ ਵਾਰੀ ਛੁੱਟੀ 'ਤੇ ਹੁੰਦਾ ਸੀ ਜਿਵੇਂ ਕੁਝ ਸਾਲ ਪਹਿਲਾਂ ਬਹੁਤ ਸਾਰੇ ਸਾਡੇ ਦੇਸ਼ ਦੇ ਬੱਚੇ ਨੇ ਜਿਹੜੇ ਪੋਲਿਓ ਦਾ ਸ਼ਿਕਾਰ ਹੋਏ ਸਨ ਤਾਂ ਉੱਥੇ ਜਿਵੇਂ ਬੁਖਾਰ ਦੀ ਹਾਲਤ ਦੇ ਵਿੱਚ ਟੀਕਾ ਲਗਾ ਦਿੱਤਾ ਜਾਂਦਾ ਸੀ ਬੱਚੇ ਦੀ ਲੱਤ ਜਾਂ ਬਾਂਂਹ ਖਰਾਬ ਹੋ ਜਾਂਦੀ ਸੀ ਕਿਉਂਕਿ ਉੱਥੇ ਲੋੜੀਂਦੀ ਜਿਹੜੀ ਮਤਲਬ ਜਾਣਕਾਰੀ ਦੀ ਘਾਟ ਸੀ ਅਤੇ ਤੁਰੰਤ ਕੋਈ ਅਜਿਹਾ ਸਰੋਤ ਵੀ ਨਹੀਂ ਸੀ ਹੁੰਦਾ ਕਿ ਉਹਨਾਂ ਨੂੰ ਅੱਗੇ ਰੈਫਰ ਕੀਤਾ ਜਾ ਸਕੇ ਜਾਂ ਤਾਂ ਕਿ ਉਹ ਛੇਤੀ ਛੇਤੀ ਆਪਣਾ ਇਲਾਜ ਕਰਾ ਕੇ ਉਹ ਠੀਕ ਹੋ ਸਰ ਹੋ ਸਕਣ ਇਸ ਪ੍ਰਕਾਰ ਜਿਵੇਂ ਕਰੋਨਾ ਦੇ ਦੌਰ ਦੇ ਵਿੱਚ ਵੀ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਆਇਆ ਕਿਉਂਕਿ ਉਹਨਾਂ ਕੋਲ ਨਾ ਸਾਧਨ ਸਨ ਨਾ ਸਰੋਤ ਸਨ ਉਹ ਪਿੰਡਾਂ ਤੋਂ ਸਮੇਂ ਸਿਰ ਸ਼ਹਿਰਾਂ ਦੇ ਵਿੱਚ ਨਹੀ ਸਨ ਪਹੁੰਚ ਸਕਦੇ ਫਿਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਰਕਾਰੀ ਮਤਲਬ ਜ ਜਿਹੜੇ ਹੈਲਥ ਸੈਟਰ ਨੇ ਜਾਂ ਕਿਤੇ ਵੀ ਕੋਈ ਟੀਕਾ ਲੱਗ ਰਿਹਾ ਹੁੰਦਾ ਸੀ ਉੱਥੇ ਬਹੁਤ ਭੀੜ ਹੁੰਦੀ ਸੀ ਇੱਕ ਦੂਸਰੇ ਤੋਂ ਦੂਰੀ ਵੀ ਬਣਾ ਕੇ ਰੱਖਣੀ ਹੁੰਦੀ ਸੀ ਅਤੇ ਇਸ ਪ੍ਰਕਾਰ ਕੇਦਰਾਂ ਦੀ ਘਾਟ ਕਾਰਨ ਸਾਡੇ ਇਲਾਕੇ ਦੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ